ਹੈਲੋ ਹਾਂਜੀ ਐਮਾਜ਼ੋਨ ਯਾਰ ਮੈਂ ਨਾ ਤੁਹਾਡੇ ਨਾ ਲਾਸ਼ਟ ਵੀਕ ਤੁਹਾਡੀ ਸਾਈਟ ਤੋਂ ਲੈਪਟਾਪ ਕੀਤਾ ਸੀਗਾ ਸੋਨੀ ਦਾ ਔਰਡਰ ਅਤੇ ਯਾਰ ਉਹ ਪਹਿਲਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਵਧੀਆ ਚੱਲਿਆ ਚੱਲਦਾ ਵੀ ਰਿਹਾ ਅਤੇ ਹੁਣ ਮੈਨੂੰ ਏਦਾਂ ਲੱਗਦਾ ਹੈ ਜਿਵੇਂ ਕਿ ਨਾ ਮੈਂ ਨਾ ਪੂਰੀ ਉਹ ਪੈਸੇ ਆ ਜਿਹੜੇ ਉਸ 'ਤੇ ਬਰਬਾਦ ਕੀਤੇ ਆ ਅਤੇ ਇੱਕ ਤਾਂ ਉਸ ਦਾ ਯਾਰ ਬੈਟਰੀ ਬੈਕਅੱਪ ਤਾਂ ਜਮ੍ਹਾਂ ਹੀ ਨਹੀਂ ਟਾਈਮ ਕੱਢ ਰਿਹਾ ਅਤੇ ਦੂਜੀ ਗੱਲ ਜਿਹੜੀ ਉਸਦੀ ਪ੍ਰੋਸੈਸਿੰਗ ਹੈ ਨਾ ਉਹ ਬੜੀ ਹੌਲ਼ੀ ਹੋ ਗਈ ਹੈ